ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੇ ਕੋਲੋਂ ਪੰਜਾਬੀ ਸੂਟ ਸਵਾਉਣਾ ਸੀਗਾ ਹਾਂਜੀ ਵੈਸੇ ਤਾਂ ਅਗਲੇ ਮੰਨਥ ਹੈ ਮੈਰਿਜ ਅਤੇ ਮੈਨੂੰ ਥੋੜ੍ਹੇ ਦਿਨ ਪਹਿਲਾਂ ਵੀ ਚਾਹੀਦਾ ਕਿਉਂਕਿ ਮੈਂ ਇੱਕ ਫੰਕਸ਼ਨ 'ਤੇ ਵੀ ਜਾਣਾ ਮਤਲਬ ਵਧੀਆ ਲੱਗੇ ਸਿੰਪਲ ਜਿਵੇਂ ਸਲਵਾਰ ਵੀ ਵਧੀਆ ਲੱਗੇ ਭਰਮੀ ਜੀ ਹਾਂਜੀ ਮੈਨੂੰ ਦਸ ਕੁ ਦਿਨਾਂ ਤੱਕ ਦੇ ਦਿਓ ਨਹੀਂ ਤੁਸੀਂ ਤੁਸੀਂ ਸੀਅ ਦੋ ਉਹ ਮੈਂ ਤੁਹਾਡੇ ਕੋਲ ਆ ਕੇ ਹੀ ਤੁਹਾਨੂੰ ਦੇ ਦੂੰਗੀ ਹਾਂਜੀ ਹਾਂਜੀ ਮੈਨੂੰ ਨਾ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਬਹੁਤ ਵਧੀਆ ਸੂਟ ਵਗੈਰਾ ਸੀਂਦੇ ਹੋ ਤਾਂ ਮੈਂ ਤੁਹਾਨੂੰ ਫ਼ੋਨ ਕੀਤਾ ਸੀਗਾ ਅਤੇ ਉਹਨਾਂ ਦੇ ਮੈਂ ਸੂਟ ਵੀ ਦੇਖੇ ਸੀਗੇ ਤੁਸੀਂ ਬੜੇ ਫਿਟਿੰਗ ਵਾਲੇ ਵਧੀਆ ਸੀਤੇ ਸੀਗੇ ਕੋਈ ਇੱਧਰ ਉੱਧਰ ਨਹੀਂ ਸੀ ਇਸ ਕਰਕੇ ਮੈਂ ਤੁਹਾਨੂੰ ਫ਼ੋਨ ਕੀਤਾ ਸੀਗਾ ਹਾਂਜੀ ਨਹੀਂ ਬਸ ਮੈਨੂੰ ਸਿੰਪਲ ਸੂਟ ਚਾਹੀਦਾ ਵਧੀਆ ਲੱਗੇ ਜੋ ਠੀਕ ਹੈ ਜੀ ਧੰਨਵਾਦ